ਵੈਸੇ ਤਾਂ ਮੈਂ ਕਾਫ਼ੀ ਥਾਵਾਂ 'ਤੇ ਘੁੰਮੀ ਹਾਂ ਪਰ ਹਾਲ ਹੀ ਮੈਂ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਗਈ ਸੀ ਉੱਥੇ ਜਾ ਕੇ ਬਹੁਤ ਹੀ ਵਧੀਆ ਲੱਗਿਆ ਅਤੇ ਉੱਥੇ ਕਾਫ਼ੀ ਸ਼ਰਧਾਲੂ ਆਏ ਸਨ ਜੋ ਗੋਲਡਨ ਟੈਂਪਲ ਵੇਖਣ ਆਏ ਸਨ ਅਤੇ ਬਹੁਤ ਹੀ ਵਧੀਆ ਆਪਣੇ ਮਨ ਦੀ ਇੱਛਾ ਨਾਲ ਮੱਥਾ ਟੇਕ ਰਹੇ ਸਨ ਗੋਲਡਨ ਟੈਂਪਲ ਦਾ ਦ੍ਰਿਸ਼ ਬਹੁਤ ਹੀ ਵਧੀਆ ਹੈ ਰਾਤ ਨੂੰ ਬਹੁਤ ਹੀ ਸੋਹਣਾ ਲੱਗਦਾ ਹੈ ਉੱਥੇ ਇੱਕ ਜਲ੍ਹਿਆਂਵਾਲਾ ਬਾਗ ਵੀ ਹੈ ਜੋ ਉੱਥੇ ਲੋਕ ਜਲ੍ਹਿਆਂਵਾਲਾ ਬਾਗ ਹੱਤਿਆ ਕਾਂਡ ਦੇ ਬਾਰੇ ਗੱਲਾਂ ਕਰ ਰਹੇ ਸਨ ਅਤੇ ਉੱਥੇ ਗੋਲੀਆਂ ਦੇ ਨਿਸ਼ਾਨ ਵੀ ਵੇਖੇ ਹਨ ਉੱਥੇ ਦੁਕਾਨਾਂ ਬਹੁਤ ਵਧੀਆ ਹਨ ਅੰਮ੍ਰਿਤਸਰੀ ਕੁਲਚੇ ਵੀ ਖਾਏ ਅਤੇ ਅਸੀਂ ਹੋਰ ਥਾਵਾਂ ਵਿੱਚੋਂ ਨੈਣਾ ਦੇਵੀ ਵੀ ਬਹੁਤ ਵਧੀਆ ਹੈ ਉੱਥੇ ਉੱਥੇ ਪਹਾੜ ਬਹੁਤ ਹੀ ਵਧੀਆ ਲੱਗਦੇ ਹਨ ਜੋ ਕਿ ਦੇਖ ਕੇ ਬਹੁਤ ਹੀ ਮਨ ਭਾਉਂਦਾ ਲਗ ਦ੍ਰਿਸ਼ ਹੁੰਦਾ ਹੈ ਲੋਕ ਉੱਥੇ ਵੀ ਕਈ ਸ਼ਰਧਾਲੂ ਆਉਂਦੇ ਹਨ ਮੱਥਾ ਟੇਕਦੇ ਹਨ ਅਤੇ ਉੱਥੇ ਮਾਤਾ ਦੇ ਦਰਸ਼ਨ ਕਰਦੇ ਹਨ ਅਤੇ ਅਸੀਂ ਉਸ ਪਹਿਲਾਂ ਇੱਕ ਵਾਰ ਸ਼ਿਮਲਾ ਵੀ ਗਏ ਉੱਥੇ ਵੀ ਸਾਨੂੰ ਬਹੁਤ ਹੀ ਵਧੀਆ ਲੱਗਿਆ ਉੱਥੇ ਰ ਸਰਦੀਆਂ ਵਿੱਚ ਬਹੁਤ ਹੀ ਠੰਢ ਹੁੰਦੀ ਹੈ ਬਰਫ਼ ਵੀ ਪੈਂਦੀ ਹੈ ਸ਼ਿਮਲੇ ਦੇ ਵਿੱਚ ਅਸੀਂ ਮੌਲ ਰੋਡ ਘੁੰਮਣ ਗਏ ਮੌਲ ਰੋਡ ਬਹੁਤ ਹੀ ਸੋਹਣਾ ਸੀ ਕਾਫ਼ੀ ਲੋਕ ਘੁੰਮਣ ਫਿਰਨ ਆਉਂਦੇ ਹਨ ਬਾਹਰਲੇ ਲੋਕ ਵੀ ਕਈ ਆਉਂਦੇ ਹਨ ਮੌਲ ਰੋਡ ਦੇ ਉੱਤੇ ਇੱਕ ਚਰਚ ਹੈ ਉੱਥੇ ਕਾਫ਼ੀ ਲੋਕ ਜਿਜਸ 'ਤੇ ਮੱਥਾ ਟੇਕਦੇ ਹਨ ਅਸੀਂ ਬਹੁਤ ਹੀ ਥਾਵਾਂ ਗਏ ਹਨ ਅਤੇ ਬਹੁਤ ਹੀ ਵਧੀਆ ਦ੍ਰਿਸ਼ ਹੁੰਦਾ ਹੈ ਅਤੇ ਬਹੁਤ ਹੀ ਮਨ ਭਾਉਂਦਾ ਹੁੰਦਾ